ਇੱਕ ਵਾਰ ਮੈਂ ਪਠਾਨਕੋਟ ਘੁੰਮਣ ਗਿਆ ਸੀਗਾ ਉੱਥੇ ਮੈਂ ਦੇਖਿਆ ਕਿ ਬਹੁਤ ਸਾਰੇ ਮੁੰਡੇ ਸਨ ਇੱਕ ਮੇਰੇ ਨਾਲ ਦਾ ਮੁੰਡਾ ਸੀ ਅਸੀਂ ਇੱਕ ਦੂਜੇ ਨੂੰ ਬੁਲਾਇਆ ਜੋ ਕਿ ਮੈਂ ਉਸਦੇ ਉਸ ਤੋਂ ਪੁੱਛ ਰਿਹਾ ਸੀ ਪਠਾਨਕੋਟ ਬਾਰੇ ਸਾਨੂੰ ਗੱਲਾਂ ਗੱਲਾਂ 'ਚ ਪਤਾ ਲੱਗਿਆ ਕਿ ਉਹਨੂੰ ਵੀ ਸਟਾਰਗੇਜਿੰਗ ਦਾ ਬਹੁਤ ਸ਼ੌਕ ਹੈ ਜੋ ਕਿ ਮੈਨੂੰ ਪਤਾ ਲੱਗਿਆ ਫਿਰ ਅਸੀਂ ਗੱਲਾਂ ਗੱਲਾਂ ਦੇ ਵਿੱਚ ਸਟਾਰਗੇਜਿੰਗ ਦੀਆਂ ਗੱਲਾਂ ਕਰਨ ਲੱਗ ਗਏ ਸਟਾਰਗੇਨਿਗ ਦਾ ਮਤਲਬ ਹੈਗਾ ਤਾਰਾ ਨਿਹਾਰਨਾ ਜੋ ਕਿ ਮੈਨੂੰ ਵੀ ਬਹੁਤ ਪਸੰਦ ਹੈ ਉਹ ਗੱਲਾਂ ਗੱਲਾਂ ਦੇ ਵਿੱਚ ਅਸੀਂ ਉਹਨੂੰ ਪਤਾ ਉਹਦਾ ਪਤਾ ਲੱਗਿਆ ਕਿ ਉਸ ਨੂੰ ਮਾਰਸ ਪਸੰਦ ਹੈ ਜਿਸ ਨੂੰ ਆਪਾਂ ਲਾਲ ਤਾਰਾ ਵੀ ਕਹਿ ਸਕਦੇ ਹਾਂ ਮੈਨੂੰ ਹੈਗਾ ਪਸੰਦ ਯੂਪੀਟਰ ਜਿਸ ਨੂੰ ਆਪਾਂ ਵੱਡਾ ਤਾਰਾ ਕਹਿ ਸਕਦੇ ਹਨ ਉਹ ਰਹਿੰਦਾ ਉਹ ਰਹਿੰਦਾ ਹੈ ਦਿੱਲੀ ਦੇ ਵਿੱਚ ਜੋ ਕਿ ਉਹ ਟੈਲੀਸਕੋਪ ਦੇ ਨਾਲ ਦੇਖ ਸਕਦਾ ਹੈ ਪਰ ਮੈਂ ਇੱਥੇ ਰਹਿੰਦਾ ਹਾਂ ਮੁਕਤਸਰ ਜਿਸ ਦੇ ਪਲ ਜਿਸ ਦੇ ਵਿੱਚ ਪੋਲਿਊਸ਼ਨ ਹੈ ਨਹੀਂ ਅਤੇ ਮੈਂ ਬਿਨਾ ਟੈਲੀਸਕੋਪ ਦੇ ਵੀ ਦੇਖ ਸਕਦਾ ਹਾਂ ਤਾਰੇ ਨਿਹਾਰਨਾ ਮੈਨੂੰ ਬਹੁਤ ਪਸੰਦ ਹੈ ਮੇਰਾ ਯਾਦਗਾਰੀ ਸਫਰ ਰਿਹਾ ਪਠਾਨਕੋਟ ਦਾ ਅਜੇ ਤੱਕ ਵੀ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ ਅਤੇ ਸਟਾਰਗੇਜਿੰਗ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਸਟਾਰਗੇਜਿੰਗ ਇੱਕ ਬਹੁਤ ਚੰਗੀ ਚੀਜ਼ ਹੈ ਆਪਾਂ ਨੂੰ ਗਲੈਕਸੀ ਬਾਰੇ ਜਾਣਨਾ ਚਾਹੀਦਾ ਹੈ ਸਟਾਰਗੇਜਿੰਗ ਅਪ ਬਹੁਤ ਸਾਰੇ ਮਿਲਕੀ ਵੇ ਗਲੈਕਸੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਸਟਾਰਗੇਜਿੰਗ ਬਹੁਤ ਵਧੀਆ ਚੀਜ਼ ਹੈ ਤਾਰਾ ਨਿਹਾਰਨਾ ਬਹੁਤ ਚੰਗੀ ਗੱਲ ਹੈ ਆਪਾਂ ਨੂੰ ਕਦੇ ਕਦੇ ਦਿੱਖਦਾ ਹੈ ਕਿ ਤਾਰਾ ਟੁੱਟਦਾ ਆਪਾਂ ਨੂੰ ਦਿੱਖਦਾ ਹੈ ਤਾਰਾ ਟੁੱਟਦਾ ਅਸਮਾਨ ਦੇ ਵਿੱਚ ਇੱਕ ਮੇਰਾ ਮਿੱਤਰ ਹੋਰ ਬਣਿਆ ਸੀ ਉਸ ਨੂੰ ਤਾਰ ਉਸ ਨੂੰ ਇਸ ਦੇ ਬਾਰੇ ਕੁਛ ਨਹੀਂ ਪਤਾ ਸੀ ਅਸੀਂ ਗੱਲਾਂ ਗੱਲਾਂ ਦੇ ਵਿੱਚ ਉਸ ਨੂੰ ਸਮਝਾਇਆ ਕਿ ਸਟਾਰਗੇਜਿੰਗ ਕੀ ਹੈ ਸਟਾਰਗੇਜਿੰਗ ਆਪਾਂ ਤਾਰਿਆਂ ਨੂੰ ਨਿਹਾਰਦੇ ਹਾਂ ਅਸੀਂ ਉਹਨਾਂ ਨੂੰ ਸਮਝਾਇਆ ਕਿ ਗਲੈਕਸੀ ਦੇ ਵਿੱਚ ਇੰਨੇ ਤਾਰੇ ਹਨ ਜੋ ਕਿ ਬਹੁਤ ਵਧੀਆ ਉਹਨੂੰ ਚੰਗਾ ਲੱਗਿਆ ਉਹਨੂੰ ਸੁਣ ਕੇ ਬਹੁਤ ਚੰਗਾ ਲੱਗਿਆ ਉਹ ਵੀ ਹੁਣ ਸਾਡੇ ਨਾਲ ਸਟਾਰਗੇਜਿੰਗ ਦੀਆਂ ਹੀ ਗੱਲਾਂ ਕਰਦਾ ਹੈ ਉਸਨੇ ਕੱਲ੍ਹ ਹੀ ਇੱਕ ਟਰਾਈਪੋਲਇਨ ਖਰੀਦਿਆ ਹੈ ਜੋ ਕਿ ਬਹੁਤ ਵਧੀਆ ਹੈ